ਅਸੀਂ ਕਈ ਕਿਸਮ ਦੇ ਪੌਦੇ ਅਤੇ ਵੇਲਾਂ ਲਗਾਉਂਦੇ ਹਾਂ ਜਿਵੇਂ ਕਿ ਪੌਦੇ ਵਿੱਚ ਬੈਂਗਣ ਭਿੰਡੀ ਮਿਰਚਾਂ ਸ਼ਿਮਲਾ ਮਿਰਚ ਅਤੇ ਵੇਲ ਵਿੱਚ ਘੀਆ ਟੀਂਡੇ ਫਲੀਆਂ ਤਰਬੂਜ਼ ਖਰਬੂਜਾ ਕਰੇਲਾ ਖੀਰਾ ਤੋਰੀ